ਸਾਡੇ ਦੇਸ਼ ਵਿੱਚ ਕਈ ਤਰ੍ਹਾਂ ਦੇ ਸਾਲਾਨਾ ਮੇਲੇ ਲੱਗਦੇ ਹਨ ਕਿਉਂਕੀ ਲੋਕ ਸ਼ਰਧਾਲੂ ਬਹੁਤ ਕੇ ਸਾ ਜਾਂਦੇ ਹਨ ਮੱਥਾ ਟੇਕਦੇ ਆ ਦਰਸ਼ਨ ਕਰਦੇ ਹਨ ਹੋਲੇ ਮਹੱਲੇ ਦਾ ਮੇਲਾ ਆਨੰਦਪੁਰ ਵਿਖੇ ਲੱਗਦਾ ਹੈ ਜੋ ਕਿ ਹੋਲੀ ਤੋਂ ਕੁਛ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਇੱਥੇ ਸ਼ਰਧਾਲੂ ਜਾਂਦੇ ਹਨ ਅਤੇ ਇਸੀ ਤਰ੍ਹਾਂ ਚਾਲਾ ਨੈਣਾ ਦੇਵੀ ਮਾਤਾ ਦੇ ਚਾਲਾ ਸ਼ੁਰੂ ਹੋ ਜਾਂਦਾ ਹੈ ਜੋ ਕਿ ਸਾਉਣ ਦੇ ਮਹੀਨੇ ਸ਼ੁਰੂ ਹੁੰਦਾ ਹੈ ਇੱਥੇ ਲੋਕ ਕਈ ਤੁਰ ਕੇ ਕਈ ਸਾਈਕਲਾਂ 'ਤੇ ਜਾਂਦੇ ਹਨ ਜੋ ਜਾਂਦੇ ਹਨ ਅਤੇ ਕਈ ਸ਼ਰਧਾਲੂ ਕਈ ਤਰ੍ਹਾਂ ਦੀ ਸੇਵਾ ਲਾਉਂਦੇ ਹਨ ਅਤੇ ਸਰਕਾਰ ਵੱਲੋਂ ਰੇਲ ਗੱਡੀ ਵੀ ਚਲਾਈ ਜਾਂਦੀ ਹੈ ਕਿ ਸ਼ਰਧਾਲੂ ਉੱਥੇ ਪਹੁੰਚਣ ਅਤੇ ਆਪਣੇ ਦਰਸ਼ਨ ਕਰਨ